ਕਈ ਅਜਿਹੇ ਕਲਾਕਾਰ ਹੁੰਦੇ ਹਨ ਜੋ ਹਮੇਸ਼ਾ ਸੱਭਿਆਚਾਰਕ ਦੀ ਗੱਲ ਕਰਦੇ ਹਨ ਅਤੇ ਸੱਭਿਆਚਾਰਕ ਨੂੰ ਸੁਰਕਸ਼ਿਤ ਰੱਖਣ ਲਈ ਰੱਖਣ ਦੀ ਕੋਸ਼ਿਸ਼ ਕਰਦੇ ਹਨ ਉਹ ਕਲਾਕਾਰ ਆਪਣੇ ਗਾਣਿਆ ਦਾ ਜਾਂ ਫਿਲਮਾਂ ਵਿੱਚ ਪੁਰਾਣੇ ਰੀਤੀ ਰਿਵਾਜਾਂ ਜਾਂ ਪੁਰਾਣੇ ਸਮੇਂ ਤੋਂ ਚਲਦੇ ਆਉਂਦੇ ਕਾਰਜਾਂ ਦੀ ਗੱਲ ਕਰਦੇ ਹਨ ਅਤੇ ਪੰਜਾਬੀ ਮਾਂ ਬੋਲੀ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਕਾਰਜ ਵੀ ਕਰਦੇ ਹਨ ਦੇਸ਼ਾਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਪੰਜਾਬੀਅਤ ਨਾਲ ਜੋੜੀ ਰੱਖਣ ਦਾ ਕੰਮ ਵੀ ਕਰ ਪੰਜਾਬ ਕਰਦੇ ਕਲਾਕਾਰ ਹਨ ਅੱਜ ਕੱਲ੍ਹ ਦੇ ਸਮੇਂ ਵਿੱਚ ਗਿੱਧਾ ਲੋਕ ਗਾਣੇ ਪੰਜਾਬੀ ਪੰਜਾਬ ਦੀਆਂ ਗੱਲਾਂ ਭੁੱਲਦੇ ਜਾ ਰਹੇ ਹਨ ਇਹ ਕਲਾਕਾਰ ਦੁਆਰਾ ਹੀ ਪਤਾ ਲੱਗ ਲੱਗ ਪਾ ਰਿਹਾ ਹੈ ਕਲਾਕਾਰ ਦੁਆਰਾ ਸੁਣ ਕੇ ਜਾਂ ਦੇਖ ਕੇ ਹੀ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾਂਦਾ ਹੈ